ਦਸਤ ਦੇ ਇਲਾਜ ਲਈ ਸਾਡੇ ਪਿੰਡ ਵਿੱਚ ਬਹੁਤ ਪ੍ਰਸਿੱਧ ਨੁਸਖੇ ਅਪਣਾਏ ਜਾਂਦੇ ਹਨ ਜਦੋਂ ਜਦੋਂ ਛੋਟੇ ਬੱਚੇ ਨੂੰ ਦਸਤ ਲੱਗ ਜਾਂਦੀ ਹੈ ਤਾਂ ਉਸ ਨੂੰ ਬਦਾਮ ਕੁੱਟ ਕੇ ਉਹਦੇ ਨਾਲ ਮਿਸ਼ਰੀ ਕੁੱਟ ਕੇ ਉਸਨੂੰ ਖਿਲਾਈ ਜਾਂਦੀ ਹਨ ਜਿਸ ਕਰਕੇ ਉਹਦੀ ਦਸਤ ਠੀਕ ਹੋ ਜਾਵੇ ਅਤੇ ਉ ਉਹਦੇ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ ਇਸ ਇਸ ਕਰਕੇ ਉਹਨੂੰ ਖੰਡ ਅਤੇ ਲੂਣ ਦਾ ਘੋਲ ਬਣਾ ਕੇ ਪਿਲਾਇਆ ਜਾਂਦਾ ਹੈ ਅਤੇ ਇਸ ਇੱਦਾਂ ਕਰਨ ਨਾਲ ਉਸਦੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ ਅਤੇ ਲੂ ਲੂਜ ਮੋਸ਼ਨ ਲੱਗਣ 'ਤੇ ਉਸ ਨੂੰ ਠੰਡੀ ਚੀਜ਼ਾਂ ਵੀ ਖਿਲਾਈ ਜਾਂਦੇ ਹਨ ਕਿਉਂਕਿ ਗਰਮੀ ਪੈਣ ਨਾਲ ਹੀ ਲੂਜ ਮੋਸ਼ਨ ਲੱਗਦੇ ਹਨ ਮੁਸੱਮੀ ਦਾ ਜੂਸ ਸੰਤਰੇ ਦਾ ਜੂਸ ਵੀ ਪਿਲਾਉਂਦੇ ਹਨ ਸਾਡੇ ਪਿੰਡ ਵਿੱਚ ਕਈ ਤਰ੍ਹਾਂ ਦੇ ਨੁਸਖੇ ਅਪਣਾਏ ਜਾਂਦੇ ਆ ਪ੍ਰਸਿੱਧ ਨੁਸਖੇ ਅਪਣਾਏ ਜਾਂਦੇ ਹਨ